ਸਤਿ ਸ਼੍ਰੀ ਅਕਾਲ ਮੈਂ ਪ੍ਰਿਅੰਕਾ ਪਠਾਨਕੋਟ ਤੋਂ ਸਰ ਕੀ ਮੈਂ ਵਿਕਟੋਰੀਆ ਕੈਫੇ ਫੋਨ ਲਗਾਇਆ ਸਰ ਮੈਂ ਤੁਹਾਨੂੰ ਪੁੱਛਣਾ ਸੀਗਾ ਕਿ ਜਿੱਦਾਂ ਕਿ ਅੱਜ ਮਦਰਸ ਡੇਅ ਆ ਕੀ ਤੁਹਾਡੇ ਪਹਿਲੀ ਗੱਲ ਅ ਵਿਕਟੋਰੀਆ ਕੈਫੇ 'ਚ ਕੋਈ ਮਦਰਸ ਡੇਅ 'ਤੇ ਕੋਈ ਔਫਰ ਚੱਲ ਰਹੀ ਆ ਕਿਉਂਕਿ ਮੈਂ ਰਾਤ ਦੇ ਲਈ ਆਪਣੇ ਫੈਮਲੀ ਨੂੰ ਡਿਨਰ ਪ੍ਰੋਵਾਈਡ ਕਰਵਾਉਣਾ ਸੀਗਾ ਅਤੇ ਮੈਂ ਚਾਹੁੰਦੀ ਸੀਗੀ ਕਿ ਮੈਂ ਉਹਨਾਂ ਨੂੰ ਅੱਜ ਡਿਨਰ 'ਤੇ ਲੈ ਕੇ ਆਵਾਂ ਅਤੇ ਜਿੱਦਾਂ ਕਿ ਮਦਰਸ ਡੇ ਹੈ ਸਪੈਸ਼ਲੀ ਮੰਮਾ ਨੂੰ ਕੁਛ ਸਪੈਸ਼ਲ ਫੀਲ ਕਰਾਉਣਾ ਚਾਹੁੰਦੀ ਸੀ ਅਤੇ ਮੈਂ ਇਹੀ ਪੁੱਛਣਾ ਸੀਗਾ ਕਿ ਤੁਹਾਡੇ ਜਿਹੜੇ ਸ਼ੁਰੂਆਤੀ ਦੇ ਜਿਹੜੇ ਆਪਣੇ ਟੇਬਲ ਹੈਗੇ ਆ ਕੀ ਤੁਸੀਂ ਉਹਨਾਂ ਲਈ ਉਹਨਾਂ 'ਤੇ ਜਿਹੜੇ ਕੁਛ ਸਪੈਸ਼ਲ ਪ੍ਰੋਗਰਾਮ ਵਗੈਰਾ ਤੁਸੀਂ ਕੀਤਾ ਹੋਇਆ ਕਿਉਂਕਿ ਮੈਨੂੰ ਮੇਰੀ ਫਰੈਂਡ ਨੇ ਦੱਸਿਆ ਸੀਗਾ ਉਹਨੇ ਆਪਣਾ ਬਰਥਡੇ ਸ਼ਾਇਦ ਤੁਹਾਡੇ ਇੱਥੇ ਸੈਲੀਬਰੇਟ ਕੀਤਾ ਸੀਗਾ ਅਤੇ ਉਹਨੇ ਮੈਨੂੰ ਦੱਸਿਆ ਸੀਗਾ ਕਿ ਤੁਹਾਡੇ ਰੈਸਟੋਰੈਂਟ 'ਚ ਬਹੁਤ ਸਾਰੀ ਪੇਸ਼ਕਸ਼ ਤੁਸੀਂ ਕਰਦੇ ਹਾਂ ਜਿੱਦਾਂ ਡਾਂਸ ਸਿੰਗਿੰਗ ਅਤੇ ਅਸੀਂ ਗਾਣਾ ਵੀ ਗਾ ਸਕਦੇ ਹਾਂ ਜਿੱਦਾਂ ਉੱਥੇ ਹੈ ਨਾ ਜਿੱਦਾਂ ਮੇਰੇ ਮਦਰਸ ਲਈ ਮੈਂ ਕੋਈ ਸੌਂਗ ਜੇ ਗਾਉਣਾ ਹੋਏ ਤਾਂ ਮੈਂ ਗਾ ਸਕਦੀ ਹਾਂ ਉੱਥੇ ਪਲੀਜ਼ ਮੈਨੂੰ ਜ਼ਰੂਰ ਦੱਸਿਓ ਕਿਉਂਕਿ ਮੈਂ ਆਪਣੀ ਮਦਰ ਨੂੰ ਅੱਜ ਸਪੈਸ਼ਲ ਫੀਲ ਕਰਾਉਣਾ ਚਾਹੁੰਦੀ ਹਾਂ ਅਤੇ ਇਸ ਕਰਕੇ ਜੇ ਤਾਂ ਤੁਹਾਡੇ ਇੱਥੇ ਹੈਗਾ ਕੁਛ ਇੱਦਾਂ ਦਾ ਤਾਂ ਮੈਂ ਜ਼ਰੂਰ ਬੁਕਿੰਗ ਕਰਵਾਵਾਂਗੀ ਅਤੇ ਮੇਰਾ ਵੈਸੇ ਇਹ ਹੀ ਨੰਬਰ ਚਲਦਾ ਤੁਸੀਂ ਮੈਨੂੰ ਇਹਦੇ 'ਤੇ ਹੀ ਆਪਣੇ ਔਫਰ ਵਗੈਰਾ ਹਾਂ ਇੱਕ ਹੋਰ ਗੱਲ ਮੈਂ ਪੁੱਛਣੀ ਸੀਗੀ ਕਿ ਜਿੱਦਾਂ ਕਿ ਮੇਰੇ ਮਦਰ ਨੂੰ ਨਾ ਮਸਾਲਾ ਡੋਸਾ ਬਹੁਤ ਪਸੰਦ ਆ ਅਤੇ ਮੈਂ ਚਾਹੁੰਦੀ ਸੀਗੀ ਕਿ ਜੇ ਤੁਹਾਡੇ ਮੈਨਿਊ 'ਚ ਮਸਾਲਾ ਡੋਸਾ ਦਾ ਅੱਛਾ ਹੈ ਤੁਹਾਡੇ ਸ਼ੈਫ ਵਧੀਆ ਬਣਾਉਂਦੇ ਆ ਤਾਂ ਮੈਨੂੰ ਜ਼ਰੂਰ ਦੱਸਿਓ ਕਿਉਂਕਿ ਮੇਰੀ ਮਦਰ ਨੂੰ ਉਹੀ ਬਹੁਤ ਪਸੰਦ ਆ ਅਤੇ ਜੇ ਉਹ ਨਹੀਂ ਅੱਛਾ ਹੋਏਗਾ ਤਾਂ ਫਿਰ ਬਾਅਦ 'ਚ ਬੈਡ ਰੀਵਿਊ ਜਾਏਗਾ ਕੁਝ ਅੱਛਾ ਰਿਵਿਊ ਨਹੀਂ ਜਾਏਗਾ ਤਾਂ ਉਹ ਵਧੀਆ ਨਹੀਂ ਲੱਗੂਗਾ ਅਤੇ ਇਸ ਕਰਕੇ ਮੈਨੂੰ ਪਹਿਲਾਂ ਹੀ ਕਨਫਰਮ ਕਰ ਦਿਓ ਕਿ ਜੇ ਤੁਹਾਡੇ ਰੈਸਟੋਰੈਂਟ 'ਚ ਤੁਹਾਡਾ ਸ਼ੈਫ ਇਹ ਵਧੀਆ ਪ੍ਰੋਵਾਈਡ ਕਰਦਾ ਤਾਂ ਠੀਕ ਆ ਅਤੇ ਮੈਨੂੰ ਸੇਮ ਨੰਬਰ 'ਤੇ ਤੁਸੀਂ ਕੋਲ ਕਰ ਦਿਓ ਠੀਕ ਹੈ ਧੰਨਵਾਦ